ਹੈਲੋ ਹਾਂਜੀ ਕੌਣ ਹਾਂਜੀ ਤੁਸੀਂ ਬੁੱਕ ਸ਼ਾਪ ਤੋਂ ਬੋਲ ਰਹੇ ਹੋ ਹਾਂਜੀ ਮੈਂ ਪ੍ਰਿਅੰਕਾ ਬੋਲ ਰਹੀ ਸੀ ਹਾਂਜੀ ਸਾਨੂੰ ਈਟੀਟੀ ਫਸਟ ਈਅਰ ਦੀਆਂ ਬੁੱਕਸ ਚਾਹੀਦੀਆਂ ਨੇ ਹਾਂਜੀ ਅਤੇ ਬੁੱਕਸ 'ਤੇ ਰੇਟ ਵਗੈਰਾ ਦੱਸ ਦਿਓ ਤੁਸੀਂ ਕਿੰਨੇ ਤੱਕ ਬਣਨਗੇ ਸਾਰੀਆਂ ਬੁੱਕਸ ਅਤੇ ਬੁੱਕਸ 'ਤੇ ਡਿਸਕਾਊਂਟ ਵਗੈਰਾ ਕਿੰਨਾ ਦਿਓਗੇ ਨਹੀਂ ਅਸੀਂ ਹੋਰ ਕਿਸੇ ਵੱਲ ਸ਼ੋਪਕੀਪਰ ਤੋਂ ਪਤਾ ਕਰੀਆਂ ਸੀ ਉਹ ਤਾਂ ਜ਼ਿਆਦਾ ਡਿਸਕਾਊਂਟ ਦੇ ਰਹੇ ਹੈ ਉਹ ਇਹਦੇ ਤੋਂ ਜ਼ਿਆਦਾ ਸੀ ਤੁਸੀਂ ਦੱਸੋ ਕਿੰਨਾ ਦਿਓਗੇ ਫਿਰ ਠੀਕ ਹੈ ਅਤੇ ਬੁੱਕਸ ਨਿਊ ਸਿਲੇਬਸ ਦੇ ਅਨੁਸਾਰ ਹੀ ਹੋਣਗੀਆਂ ਨਾ ਅਤੇ ਬੁੱਕਸ ਬੁੱਕਸ ਸਾਰੀਆਂ ਵਧੀਆ ਹਾਲਤ ਹਾਂਜੀ ਵਧੀਆ ਹਾਲਤ ਵਿੱਚ ਹੋਣਗੀਆਂ ਜੇ ਸਾਨੂੰ ਕੋਈ ਬੁੱਕ ਵਿੱਚ ਕੋਈ ਵੀ ਦਿੱਕਤ ਲੱਗਦੀ ਏ ਅਤੇ ਫਿਰ ਅਸੀਂ ਬਦਲ ਸਕਦੇ ਏ ਨਾ ਅਤੇ ਬੁੱਕਸ ਬਾਇੰਡ ਵਗੈਰਾ ਕੀਤੀਆਂ ਹੋਣਗੀਆਂ ਨਾ ਹਾਂਜੀ ਅਤੇ ਬੁੱਕਸ ਮੰਗਵਾਉਂਦੇ ਆ ਤਾਂ ਕਿੰਨੇ ਦਿਨਾਂ ਦੇ ਵਿੱਚ ਵਿੱਚ ਪਹੁੰਚ ਜਾਣਗੀਆਂ

ਹਾਂਜੀ ਹਾਂਜੀ ਫਸਟ ਈਟੀਟੀ ਫਸਟ ਈਅਰ ਦੀਆਂ ਐਕਸਪਰਟਸ ਦੀਆਂ ਬੁੱਕਸ ਚਾਹੀਦੀਆਂ ਨੇ ਸਾਨੂੰ ਹਾਂਜੀ ਸਾਰਾ ਸੈੱਟ ਹੀ ਚਾਹੀਦਾ ਪੇਮੈਂਟ ਕੈਸ਼ ਹੀ ਕਰ ਦਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਹਾਂਜੀ ਹਾਂਜੀ ਥੈਂਕ